ਇਹ ਵਿੱਚ ਬੋਲੂ ਕੋਈ ਚੱਕਰ ਤਾਂ ਨਹੀਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਯਾ ਹਾਲ ਹੈ ਹਾਂਜੀ ਕੋਈ ਨਹੀਂ ਆਜਿਓ ਤੁਹਾਨੂੰ ਘੁੰਮਾ ਲਿਆਵਾਂਗੇ ਅਸੀਂ ਸਾਡੇ ਇੱਥੇ ਬਹੁਤ ਢਾਬੇ ਨੇ ਅੰਮ੍ਰਿਤ ਢਾਬਾ ਏ ਗੋਬਿੰਦ ਢਾਬਾ ਏ ਭੈਣਾਂ ਦਾ ਢਾਬਾ ਏ ਇੱਕ ਰਾਜਾ ਢਾਬਾ ਏ ਇੱਥੇ ਸਾਰਾ ਕੁਝ ਬਹੁਤ ਵਧੀਆ ਮਿਲਦਾ ਏ ਖਾਣੇ ਲਈ ਸਾਰੀਆਂ ਚੀਜ਼ਾਂ ਵਧੀਆ ਸਾਫ਼ ਸਫਾਈ ਦਾ ਵੀ ਬਹੁਤ ਉਹ ਹੈ ਹਾਂਜੀ ਮਠਿਆਈਆਂ ਹਾਂਜੀ ਹਾਂ ਖਾਣਾ ਪੀਣਾ ਬਹੁਤ ਵਧੀਆ ਸੀ ਆਪਣੀ ਫੈਮਿਲੀ ਨਾਲ਼ ਜਾਂਦੇ ਈ ਰਹਿੰਦੇ ਹਾਂ ਹਾਂਜੀ ਹਾਂ ਤੁਸੀਂ ਆਜਿਓ ਜਦ ਮਰਜ਼ੀ ਆ ਜਿਓ ਅਸੀਂ ਤੁਹਾਨੂੰ ਘੁੰਮਾ ਲਿਆਵਾਂਗੇ ਹੋਰ ਸੁਣਾਓ ਘਰੇ ਠੀਕ ਠਾਕ ਉੱਥੇ ਵੈਸੇ ਤਾਂ ਸਭ ਕੁਝ ਹੈ ਪਰ ਉੱਥੇ ਦੀ ਦਾਲ ਮਖਣੀ ਹੋਗਈ ਭਟੂਰੇ ਛੋਲੇ ਸਭ ਕੁਝ ਬਹੁਤ ਵਧੀਆ ਏ ਸਸਤਾ ਵੀ ਹੈ ਰੇਟ ਵੀ ਸਹੀ ਹੈ ਉਹਨਾਂ ਦਾ ਤੁਹਾਡੀ ਕੋਲ ਹੌਲਡ ਕੀਤੀ ਗਈ ਹੈ ਕ੍ਰਿਪਾ ਕਰਕੇ ਲਾਈਨ 'ਤੇ ਬਣੇ ਰਵੋ ਆਪਕਾ ਕੋਲ ਹੌਲਡ ਪਰ ਹੈ ਲਾਈਨ ਪਰ ਬਨੇ ਰਹੇਂ ਜਾਂ ਕੁਝ ਦੇਰ ਬਾਅਦ ਕੋਸ਼ਿਸ਼ ਕਰੇਂ ਹੈਲੋ ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਇਹਨਾਂ ਦਾ ਰੇਟ ਵੀ ਬਹੁਤ ਵਧੀਆ ਇਹਨਾਂ ਦੀ ਸਾਫ਼ ਸਫਾਈ ਦਾ ਵੀ ਬਹੁਤ ਵਧੀਆ ਇਹਨਾਂ ਦੀ ਸੀਟਿੰਗ ਵੀ ਬਹੁਤ ਵਧੀਆ ਇਨ੍ਹਾਂ ਦੇ ਸਭ ਕੁਝ ਵਧੀਆ ਏ ਏ ਸੀ ਹਾਲ ਨੇ ਸਾਰਾ ਕੁਝ ਪਾਰਟੀ ਵਗੈਰਾ ਵਾਸਤੇ ਵੀ ਠੀਕ ਹੈ ਠੀਕ ਹੈ ਜੀ ਠੀਕ ਹੈ ਜਦ ਮਰਜ਼ੀ ਆਜਿਓ ਤੁਹਾਡੀ ਕੌਲ